ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਤੁਹਾਡੇ ਤੋਂ ਮੋਬਾਇਲ ਔਡਰ ਕੀਤਾ ਸੀ ਸੈੱਮਸੰਗ ਦਾ ਜੇ ਸੈਵਨ ਉਹਦੀ ਕੋਆਲਟੀ ਬਹੁਤ ਵਧੀਆ ਹੈ ਜੀ ਬੈਟਰੀ ਪੈਕਅੱਪ ਬਹੁਤ ਸੋਹਣਾ ਹੈ ਕੈਮਰਾ ਵੀ ਬਹੁਤ ਸੋਹਣਾ ਹੈ ਅਤੇ ਪ੍ਰੋਸੈਸਰ ਵੀ ਬਹੁਤ ਵਧੀਆ ਹੈ ਹੁਣ ਮੇਰਾ ਕੋਈ ਵੀ ਕੰਮ ਨਹੀਂ ਰੁਕਦਾ ਜਿਵੇਂ ਮੈਂ ਆਪਣੇ ਕੰਮ ਦੇ ਰਿਲੇਟਿਵ ਕੁਛ ਵੀ ਕਰਨਾ ਹੈ ਤਾਂ ਮੇਰਾ ਪਹਿਲਾ ਫੋਨ ਸੀ ਜੋ ਹੈਂਗ ਹੁੰਦਾ ਸੀ ਪਰ ਇਹਦਾ ਪ੍ਰੋਸੈਸਰ ਵੱਡਾ ਹੈ ਵੀ ਹੁਣ ਵਧੀਆ ਆਉਂਦਾ ਹੈ ਅਤੇ ਵੋਲੀਅਮ ਵੀ ਬਹੁਤ ਵਧੀਆ ਇਹਦੀ ਅਤੇ ਡਿਸਪਲੇਅ ਵੀ ਕਾਫ਼ੀ ਵੱਡੀ ਹੈ ਅਤੇ ਐੱਚ ਡੀ ਆ ਵਧੀਆ ਹੈ ਪਲੱਸ ਜੋ ਚਾਰਜਰ ਆ ਚਾਰਜਰ ਵੀ ਜਲਦੀ ਹੋ ਜਾਂਦਾ ਅਤੇ ਬੈਟਰੀ ਪੈਕਅੱਪ ਵੀ ਬਹੁਤ ਸੋਹਣਾ ਇਹਦਾ ਹੈ ਅਤੇ ਹੋਰ ਹੱਲ ਕੀ ਹੁਣ ਫਾਈਵ ਜੀ ਲੋਂਚ ਹੋ ਗਿਆ ਅਤੇ ਹੁਣ ਇਹ 'ਚ ਫਾਈਵ ਜੀ ਸਿਮ ਵੀ ਪੈਂਦਾ ਹੈ ਅਤੇ ਜਿਹਦੇ ਕਰਕੇ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋ ਗਿਆ ਹੈ